ਮੇਰਾ ਸਭ ਤੋਂ ਯਾਦਗਾਰੀ ਖੇਡ ਅਨੁਭਵ ਉਸ ਸਮੇਂ ਦਾ ਸੀ ਜਦੋਂ ਮੇਰੀ ਉਮਰ ਵੀਹ ਸਾਲ ਦੀ ਸੀ ਅਤੇ ਮੈਂ ਆਪਣੇ ਸਕੂਲ ਵਿੱਚ ਪਲਸ ਟੂ ਦਾ ਵਿਦਿਆਰਥੀ ਸੀ ਅਤੇ ਮੈਂ ਉਸ ਸਕੂਲ ਵਿੱਚ ਇੱਕ ਕ੍ਰਿਕਟ ਟੀਮ ਦੇ ਖਿਡਾਰੀ ਵੀ ਸੀ ਅਤੇ ਸਾਡੇ ਸਕੂਲ ਵਿੱਚ ਇੱਕ ਟੂਰਨਾਮੈਂਟ ਕਰਵਾਇਆ ਜਾਂਦਾ ਸੀ ਅਤੇ ਮੈਂ ਉਸ ਟੂਰਨਾਮੈਂਟ ਵਿੱਚ ਭਾਗ ਲਿਆ ਅਤੇ ਭਾਗ ਲੈਣ ਤੋਂ ਬਾਅਦ ਸਾਡੀ ਟੀਮ ਫਾਈਨਲ ਦੇ ਵਿੱਚ ਪੁੱਜੀ ਅਤੇ ਫਾਈਨਲ ਮੈਚ ਵਿੱਚ ਮੇਰਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਅਤੇ ਜਿਸ ਨਾਲ ਸਾਡੀ ਟੀਮ ਵੀ ਜਿੱਤ ਗਈ ਸੀ ਅਤੇ ਮੈਂ ਉਸ ਟੂਰਨਾਮੈਂਟ ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਜਿਸ ਵਿੱਚ ਮੈਂ ਤਰਤਾਲੀ ਰਨ ਬਣਾਏ ਅਤੇ ਨਾਲ ਦੋ ਵਿਕਟਾਂ ਵੀ ਲਈਆਂ ਅਤੇ ਜਿਸ ਨਾਲ ਮੇਰੇ ਸਕੂਲ ਦੇ ਸਾਰੇ ਹੀ ਪਲੇਅਰਾਂ ਅਤੇ ਸਰਾਂ ਮੈਡਮਾਂ ਨੇ ਮੈਨੂੰ ਬਹੁਤ ਸ਼ਾਬਾਸ਼ ਦਿੱਤੀ ਅਤੇ ਜਿਸ ਨਾਲ ਮੈਨੂੰ ਉਹ ਗੱਲ ਦਾ ਅੱਜ ਵੀ ਬਹੁਤ ਮਾਣ ਹੁੰਦਾ ਹੈ